ਹਾਂਜੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੇਰੀ ਸਟੱਡੀ ਕੰਪਲੀਟ ਹੋ ਗਈ ਤਾਂ ਉਦੋਂ ਬੜਾ ਮਹੱਤਵਪੂਰਨ ਡਿਸੀਜ਼ਨ ਜੋ ਮੈਂ ਲਿਆ ਹੈ ਕਿਉਂ ਮੈਂ ਉਦੋਂ ਸੋਚਿਆ ਸੀ ਮੈਂ ਜੌਬ ਕਰਨੀ ਹੈ ਜਾਂ ਮੈਂ ਬਿਜ਼ਨਸ ਕਰਨਾ ਹੈ ਸੋ ਮੈਂ ਕਾਫ਼ੀ ਕਨਫ਼ਿਉਜ਼ ਰਿਹਾ ਆਈ ਥਿਂਕ ਇੱਕ ਹਫ਼ਤਾ ਮੈਂ ਕਨਫ਼ਿਊਜ਼ ਰਿਹਾ ਅਤੇ ਮੈਂ ਡਿਪਰੈਸ਼ਨ 'ਚ ਵੀ ਰਿਹਾ ਕਿਉਂਕਿ ਮੈਂ ਸੋਚਦਾ ਸੀ ਵੀ ਮੈਂ ਬਿਜ਼ਨਸ ਸ਼ੁਰੂ ਕਰਾਂ ਔਰ ਮੈਂ ਜੌਬ ਕਰੀਏਟਿੰਗ ਕਰਾਂ ਮੈਂ ਲੋਕਾਂ ਨੂੰ ਜੌਬ ਦੇਵਾਂ ਨਾ ਕਿ ਮੈਂ ਆਪ ਜੌਬ ਕਰਾਂ ਸੋ ਮੈਂ ਸੋਚਿਆ ਸੀ ਇਹ ਅੱਛੀ ਅੋਪਰਚਿਊਨਿਟੀ ਹੈ ਕਿ ਮੈਂ ਜੌਬ ਕਰੀਏਟਿੰਗ ਕਰਾਂ ਤਾਂ ਇਸ ਲਈ ਮੈਂ ਆਪਣੇ ਪੇਰੈਂਟਸ ਦੀ ਸਲਾਹ ਲਈ ਕਿਉਂਕਿ ਉਹਨਾਂ ਕੋਲ ਜ਼ਿਆਦਾ ਐਕਸਪੀਂਰੀਅਸ ਕਿਉਂ ਕਿਉਂਕਿ ਮਾਈ ਫਾਦਰ ਵੀ ਉਹ ਵੀ ਬਿਜ਼ਨਸਮੈਨ ਹੈ ਅਤੇ ਉਹ ਮੈਨੂੰ ਚੰਗੀ ਸਲਾਹ ਦੇ ਸਕਦੇ ਸੀ ਅਤੇ ਮੈਂ ਉਹਨਾਂ ਕੋਲ ਗਿਆ ਅਤੇ ਉਹਨਾਂ ਨੇ ਮੈਨੂੰ ਪਹਿਲਾਂ ਤਾਂ ਐਪਰੀਸ਼ੇਟ ਕੀਤਾ ਵੀ ਹਾਂ ਇਹ ਸਹੀ ਡਿਸੀਜ਼ਨ ਹੈ ਵੀ ਤੁਸੀਂ ਆਪ ਖੁਦ ਜੌਬ ਜਨਰੇਟ ਕਰੋ ਜਿਸਦੇ ਨਾਲ ਕਿ ਲੋਕਾਂ ਨੂੰ ਵੀ ਫ਼ਾਈਦਾ ਹੋਵੇ ਅਤੇ ਉਹ ਵੀ ਪੈਸੇ ਕਮਾ ਸਕਣ ਅਤੇ ਆਪਣੀ ਫੈਮਿਲੀ ਦੇ ਨਾਲ ਆਪਣਾ ਅਪਲਿਫ਼ਟ ਕਰ ਸਕਣ ਗੁਜ਼ਾਰਾ ਚੰਗੀ ਤਰ੍ਹਾਂ ਕਰ ਸਕਣ ਸੋ ਮੇਰਾ ਇਸ ਡਿਸੀਜ਼ਨ ਸਹੀ ਰਿਹਾ ਅਤੇ ਹੁਣ ਮੇਰਾ ਆਪਣਾ ਬਿਜ਼ਨਸ ਹੈ ਅਤੇ ਕਾਫੀ ਚੰਗਾ ਚੱਲ ਰਿਹਾ ਹੈ ਕਾਫ਼ੀ ਅੱਛੀ ਤਰ੍ਹਾਂ ਨਾਲ ਰਨਿੰਗ ਕਰ ਰਿਹਾ ਹੈ